ਪੰਜਾਬੀ ਭਾਸ਼ਾ ਦੀ ਵਰਤੋਂ ਵਪਾਰ ਅਤੇ ਵਣਜ ਵਿੱਚ ਜਿਵੇਂ ਕਿ ਹੈ ਨਾ ਆਪਾਂ ਕਿਤੇ ਬਾਹਰ ਕਾਰੋਬਾਰ ਕਰਦੇ ਹਾਂ ਤਾਂ ਉਸ ਨਾਲ ਪਹਿਲਾਂ ਪੰਜਾਬੀ ਵਿੱਚ ਗੱਲ ਕਰੋ ਅਤੇ ਆਪਣੇ ਵਣਜ ਵਪਾਰ ਬਾਰੇ ਗੱਲ ਦੱਸੀ ਜਾਵੇ ਫਿਰ ਆਪਣੇ ਰੁਜ਼ਗਾਰ ਦੀ ਗੱਲ ਕਰੋ ਅਤੇ ਉਹਨੂੰ ਚੰਗੀ ਤਰ੍ਹਾਂ ਸਮਝਾਓ ਕਿ ਜਿਵੇਂ ਕਿ ਸਮਾਜ ਦਾ ਕੰਮ ਧੰਦਾ ਅਤੇ ਮਨੁੱਖ ਦੀ ਉਤਪਤੀ ਦੀ ਲੋੜ ਸਮਾਜ ਸਬੰਧ ਦੀ ਲੋੜ ਦੀ ਜਨਮ ਦਿੰਦੀ ਹੈ ਕੰਮ ਵਿਕਾਸ ਦੇ ਨਾਲ ਨਿੱਜੀ ਜਾਇਦਾਦ ਦੀ ਪ੍ਰਥਾ ਦਾ ਵਿਕਾਸ ਨਾਲ ਪਰਿਵਾਰ ਦੀ ਬਣਤਰ ਬਦਲਦੀ ਹੈ ਪਹਿਲਾਂ ਕਬੀਲਾ ਸਮਿ ਸਿਸਟਮ ਪ੍ਰਚਲਿਤ ਸੀ ਇਹ ਕਬੀਲਾ ਆਪਣੇ ਆਪ ਵਿੱਚ ਸੁਤੰਤਰਤਾ ਆਰਥਿਕ ਇਕਾਈ ਹੁੰਦਾ ਹੁੰਦਾ ਸੀ ਅਤੇ ਪਹਿਲਾਂ ਵਿਆਹ ਕਬੀਲੇ ਦੇ ਅੰਦਰ ਹੀ ਹੁੰਦੇ ਸਨ ਹੌਲੀ ਹੌਲੀ ਇੱਕ ਕਬੀਲੇ ਤੋਂ ਦੂਸਰੇ ਕਬੀਲੇ ਨਾਲ ਹੋਣ ਲੱਗੇ ਜਦੋਂ ਕਿ ਜਦੋਂ ਖੇਤੀ ਪ੍ਰਧਾਨ ਸਮਾਜ ਉਸਾਰਨ ਲੱਗਾ ਤਾਂ ਕਬੀਲਾ ਸਮਾਜ ਦੀ ਥਾਂ 'ਤੇ ਖੇਤੀ ਪ੍ਰਧਾਨ ਸਮਾਜ ਨੇ ਲੈ ਲਈ ਬਹੁ ਵਿਆਹ ਦੀ ਪ੍ਰਥਾ ਦੀ ਥਾਂ ਇੱਕ ਵਿਆਹ ਪ੍ਰਥਾ ਪ੍ਰਚਲਿਤ ਹੋ ਗਈ ਇਸ ਤਰ੍ਹਾਂ ਵਰਤਾਵੇ ਨੂੰ ਅੰ ਆਧਾਰਿਤ ਕਰਨ ਲਈ ਸਮਾਜ ਪ੍ਰਬੰਧ ਹੋਂਦ ਵਿੱਚ ਆਇਆ ਸਮਾਜ ਪ੍ਰਬੰਧ ਵਿੱਚ ਸਮੁੱਚੀ ਸਮਾਜਿਕ ਬੰ ਬਣਤਰ ਪਿੰਡ ਪਰਿਵਾਰ ਦੇ ਇਸ ਰਿਸ਼ਤੇ ਨਾਤੇ ਜਾਤ ਦੀ ਵੰਡ ਕਿੱਤਿਆਂ ਦੀ ਵੰਡ ਅਤੇ ਵਿਆਹ ਦਾ ਸੰਚਾਲਨ ਵਰਗ ਸਾਰੇ ਸਮਾਜ ਕਾਰਜ ਸ਼ਾਮਲ ਕੀਤੇ ਜਾ ਸਕਦੇ ਹਨ ਸਮਾਜ ਪ੍ਰਬੰਧ ਸੱਭਿਆਚਾਰ ਬਹੁਤ ਹੀ ਮਹੱਤਵਪੂਰਨ ਹੈ ਅਤੇ ਆਪਣੇ ਵਣਜ ਵਪਾਰ ਦੀ ਗੱਲ ਕੁਝ ਇਸ ਤਰ੍ਹਾਂ ਕਰੋ ਕਿ ਦੂਜੇ ਬੰਦੇ ਨੂੰ ਵੀ ਸਮਝ ਆਵੇ ਅਤੇ ਵਣਜ ਵਪਾਰ ਤਾਂ ਚੰਗੀ ਗੱਲ ਹੈ ਜਿਵੇਂ ਕਿ ਕਿਸੇ ਨੂੰ ਕਹਿੰਦੇ ਹਾਂ ਕਿ ਮੇਰਾ ਆਹ ਕਾਰੋਬਾਰ ਚੱਲਦਾ ਅਤੇ ਉਸਨੂੰ ਸਮਝਾਉਣਾ ਬਹੁਤੀ ਔਖੀ ਗੱਲ ਨਹੀ ਹੁੰਦੀ ਉਹਨੂੰ ਚੰਗੀ ਤਰ੍ਹਾਂ ਸਮਝਾਓ ਅਤੇ ਪੁੱਛੋ ਕਹੋ ਉਹਨੂੰ ਆਪਣੇ ਵਪਾਰ ਬਾਰੇ ਦੱਸੋ ਜੇ ਆਪਾਂ ਵਪਾਰ ਇੱਕ ਦੂਜੇ ਨਾਲ ਕਰਦੇ ਹਾਂ ਤਾਂ ਫਿਰ ਹੀ ਦੂਜੇ ਦੇ ਮੰਚ ਦਾ ਪਤਾ ਲੱਗਦਾ ਇਸ ਕਰਕੇ ਪਹਿਲਾਂ ਚੰਗੀ ਤਰ੍ਹਾਂ ਸਮਝਾਓ ਅਤੇ ਆਪਣਾ ਵਪਾਰ ਵਣਜ ਚੰਗੀ ਤਰ੍ਹਾਂ ਰੱਖੋ